ਸਤਿ ਸ਼੍ਰੀ ਅਕਾਲ ਮੰਮਾ ਜੀ ਮੈਨੂੰ ਕਨੇਡਾ ਯੂਨੀਵਰਸਿਟੀ 'ਚ ਦਾਖਲਾ ਮਿਲ ਗਿਆ ਹੈ ਹੁਣ ਮੈਂ ਆਪਣਾ ਪਾਸਪੋਰਟ ਦੇ ਵੀਜੇ ਲਵਾਉਣ ਲਈ ਉਸਨੂੰ ਰੀਨਿਊ ਕਰਵਾਉਣ ਲਈ ਮੈਂ ਪਾਸਪੋਰਟ ਦਫ਼ਤਰ ਚੱਲੀ ਹਾਂ ਮੈਂ ਪਾਸਪੋਰਟ ਦਫ਼ਤਰ ਪਹੁੰਚ ਕੇ ਫਿਰ ਤੁਹਾਡੇ ਨਾਲ ਗੱਲ ਕਰਦੀ ਹਾਂ ਜੀ ਹਾਂਜੀ ਹਾਂਜੀ ਹਾਂਜੀ ਮੈਂ ਚੱਲੀ ਹਾਂ ਦੀਦੀ ਪਾਸਪੋਰਟ ਦਫ਼ਤਰ ਚੱਲੀ ਹਾਂ ਮੰਮਾ ਜੀ ਹੁਣ ਪਾਸਪੋਰਟ ਦਫ਼ਤਰ ਜਾ ਕੇ ਮੈਂ ਆਪਣਾ ਪਾਸਪੋਰਟ ਨੀਰਿਊ ਕਰਵਾਉਣ ਲਈ ਦੇਣ ਲਈ ਪਹੁੰਚ ਗਈ ਮੰਮੀ ਜੀ ਹਾਂਜੀ ਪਹੁੰਚ ਗਈ ਪਾਸਪੋਰਟ ਨੀਰਿਊ ਕਰਵਾਉਣ ਲਈ ਮੈਂ ਦਫ਼ਤਰ ਪਾਸਪੋਰਟ ਵਾਲਿਆਂ ਨੂੰ ਮਿਲੀ ਅਤੇ ਉਹਨਾਂ ਨੇ ਮੈਨੂੰ ਪਾਸਪੋਰਟ ਰੀਨਿਊ ਕਰਨ ਲਈ ਮੇਰਾ ਲੈ ਲਿਆ ਹੈ ਹੁਣ ਮੇਰਾ ਪਾਸਪੋਰਟ ਹੋ ਕੇ ਆ ਜਾਏਗਾ ਜਿਸ ਲਈ ਮੇਰਾ ਵੀਜਾ ਮੈਨੂੰ ਮਿਲ ਜਾਵੇਗਾ ਮੰਮੀ ਮੈਨੂੰ ਬਹੁਤ ਹੀ ਖੁਸ਼ੀ ਆ ਮੈਂ ਜਲਦੀ ਤੋਂ ਜਲਦੀ ਤੁਹਾਨੂੰ ਆ ਕੇ ਮਿਲਾਂਗੀ ਹਾਂਜੀ